ਅੱਜ ਕੱਲ੍ਹ ਮੋਬਾਈਲ ਫ਼ੋਨ ਸੰਚਾਰ ਦਾ ਹਰਮਨ ਪਿਆਰਾ ਸਾਧਨ ਬਣ ਗਿਆ ਹੈ ਜਿਸ ਨੂੰ ਸੈੱਲਫ਼ੋਨ ਵੀ ਕਹਿੰਦੇ ਹਨ ਵਰਤਮਾਨ ਸੰਸਾਰ ਵਿੱਚ ਸੰਚਾਰ ਦਾ ਸਭ ਤੋਂ ਹਰਮਨ ਪਿਆਰਾ ਸਾਧਨ ਬਣ ਗਿਆ ਹੈ ਅੱਜ ਤੁਸੀਂ ਭਾਵੇਂ ਕਿਤੇ ਵੀ ਹੋਵੇ ਤੁਹਾਨੂੰ ਇੱਧਰ ਉੱਧਰ ਕੋਈ ਨਾ ਕੋਈ ਸੈੱਲਫ਼ੋਨ ਉੱਤੇ ਗੱਲਾਂ ਕਰਦਾ ਦਿਸ ਪਵੇਗਾ ਜਾਂ ਘੱਟੋ ਘੱਟ ਕਿਸੇ ਦੀ ਜੇਬ ਜਾਂ ਪਰਸ ਵਿੱਚ ਸੈੱਲਫ਼ੋਨ ਦੀ ਘੰਟੀ ਵੱਜਦੀ ਜ਼ਰੂਰ ਸੁਣ ਪਵੇਗੀ ਅੱਜ ਤੋਂ ਚੌਵੀ ਪੱਚੀ ਸਾਲ ਪਹਿਲਾਂ ਜਦੋਂ ਅਮਰੀਕਾ ਵਿੱਚ ਅਤੇ ਬਾਰਾਂ ਤੇਰਾਂ ਸਾਲ ਪਹਿਲਾਂ ਭਾਰਤ ਵਿੱਚ ਇਸਦਾ ਪ੍ਰਚਲਣ ਆਰੰਭ ਹੋਇਆ ਤਾਂ ਇਸ ਨੂੰ ਇੱਕ ਨਾਇਬ ਚੀਜ਼ ਸਮਝਿਆ ਜਾਂਦਾ ਸੀ ਪਰ ਅੱਜ ਇਹ ਬਹੁਤ ਜ਼ਰੂਰੀ ਚੀਜ਼ ਬਣ ਗਈ ਹੈ ਬੇਸ਼ੱਕ ਪਹਿਲਾਂ ਸੈੱਲਫ਼ੋਨ ਐਨਾਲਾਗ ਸਨ ਪਰੰਤੂ ਉੱਨੀ ਸੌ ਅੱਸੀ ਤੋਂ ਮਗਰੋਂ ਡਿਜ਼ੀਟਲ ਸਿਸਟਮ ਉੱਤੇ ਜ਼ੋਰ ਦਿੱਤਾ ਗਿਆ ਜੋ ਕਿ ਘੱਟ ਕੀਮਤ ਵਿੱਚ ਵਧੀਆ ਆਵਾਜ਼ 'ਤੇ ਸੇਵਾ ਦਿੰਦਾ ਸੀ ਅਤੇ ਨਾਲ਼ ਹੀ ਇਸ ਵਿੱਚ ਹੋਰ ਬਹੁਤ ਸਾਰੇ ਫੀਚਰ ਵੀ ਸ਼ਾਮਿਲ ਕੀਤੇ ਜਾ ਸਕਦੇ ਸਨ ਆਮ ਲੋਕਾਂ ਦੁਆਰਾ ਪਹਿਲੀ ਵਾਰੀ ਸੈੱਲਫ਼ੋਨ ਸੇਵਾ ਦੀ ਵਰਤੋਂ ਦਾ ਆਰੰਭ ਸਹੀ ਅਰਥਾਂ ਵਿੱਚ ਇੱਕ ਨੌ ਅੱਠ ਤਿੰਨ ਵਿੱਚ ਅਮਰੀਕਾ ਵਿਖੇ ਹੋਇਆ ਅਤੇ ਮਗਰੋਂ ਇਸ ਸੰਚਾਰ ਸਾਧਨ ਦੀ ਲੋਕਪ੍ਰਿਯਤਾ ਦਿਨੋਂ ਦਿਨ ਆਪਣੇ ਪੈਰ ਪਸਾਰਦੀ ਗਈ ਇਸ ਸਮੇਂ ਸੈੱਲਫ਼ੋਨ ਬਹੁਤ ਹੀ ਜ਼ਰੂਰੀ ਬਣ ਗਿਆ ਹੈ ਲੋਕ ਇੱਥੇ ਇੱਕ ਦੂਜੇ ਨੂੰ ਵੀਡੀਓ ਵੀ ਭੇਜ ਸਕਦੇ ਹਨ ਅਤੇ ਕੋਈ ਵੀ ਚੀਜ਼ ਸਰਚ ਕਰ ਸਕਦੇ ਹਨ ਇਸ ਕਰਕੇ ਅੱਜ ਕੱਲ੍ਹ ਸੈੱਲਫ਼ੋਨ ਬਹੁਤ ਜ਼ਰੂਰੀ ਹੋ ਗਿਆ ਹੈ ਧੰਨਵਾਦ